ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਬੋਲ ਰਹੀ ਹਾਂ ਤੁਸੀਂ ਲੱਕੀ ਢਾਬੇ ਬੋਲ ਰਹੇ ਹੋ ਹਾਂਜੀ ਸਰ ਮੈਂ ਨਾ ਖਾਣਾ ਆਰਡਰ ਕੀਤਾ ਸੀ ਤੁਹਾਡੇ ਢਾਬੇ ਤੋਂ ਦਾਲ ਮੱਖਣੀ ਸੀ ਸ਼ਾਹੀ ਪਨੀਰ ਸੀ ਮਿਕਸ ਵੈੱਜ ਔਰ ਦਸ ਰੋਟੀਆਂ ਆਰਡਰ ਕੀਤੀਆਂ ਸੀ ਪਰ ਮੈਂ ਹੁਣ ਨਾ ਔਨਲਾਈਨ ਚੈੱਕ ਕੀਤਾ ਏ ਤੁਹਾਡਾ ਨਾ ਆਰਡਰ ਹਜੇ ਹੋਟਲ ਤੋਂ ਨਹੀਂ ਚੱਲਿਆ ਹੈਗਾ ਪਰ ਕਿਸੇ ਨਾ ਕਾਰਨ ਵਸ਼ ਸਰ ਮੈਨੂੰ ਘਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਇਸ ਕਰਕੇ ਨਾ ਮੈਂ ਆਰਡਰ ਨਹੀਂ ਲੈ ਸਕਦੀ ਹੈਗੀ ਮੇਰੀ ਮਜ਼ਬੂਰੀ ਹੋ ਗਈ ਸਰ ਰਿਕੁਏਸਟ ਆ ਸਰ ਤੁਸੀਂ ਨਾ ਮੇਰਾ ਜਿਹੜਾ ਆਰਡਰ ਸੀ ਉਹ ਰੱਦ ਕਰ ਦੋ